ਚਿੱਤਰਕਾਰੀ ਸਟਰੈਸ ਨੂੰ ਦੂਰ ਕਰਨ ਦਾ ਇੱਕ ਬਹੁਤ ਵਧੀਆ ਸਾਧਨ ਹੈ ਜੇ ਗੱਲ ਚਿੱਤ ਅ ਮੇਰੀ ਮਨਪਸੰਦ ਚਿੱਤਰਕਾਰ ਦੀ ਕੀਤੀ ਜਾਵੇ ਤਾਂ ਮੇਰੀ ਮੈਡਮ ਜਿਹੜੇ ਮਲਕੀਤ ਮੈਡਮ ਸੀਗੇ ਸਾਡੇ ਡਰਾਇੰਗ ਦੇ ਟੀਚਰ ਉਹ ਮੇਰੇ ਮਨਪਸੰਦ ਚਿੱਤਰਕਾਰ ਸੀਗੇ ਕਿਉਂਕਿ ਉਹਨਾਂ ਦੀ ਡਰਾਇੰਗ ਬਹੁਤ ਵਧੀਆ ਹੁੰਦੀ ਸੀਗੀ ਜਦੋਂ ਉਹ ਸਾਡੀ ਕਲਾਸ ਦੇ ਵਿੱਚ ਪੜਾਉਂਦੇ ਸੀਗੇ ਤਾਂ ਉਹ ਖੁਦ ਵੀ ਡਰਾਇੰਗ ਕਰਨਾ ਬਹੁਤ ਪਸੰਦ ਕਰਦੇ ਸੀਗੇ ਤਾਂ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਪਰ ਮੈਨੂੰ ਐਜ਼ ਏ ਪ੍ਰੋਫੈਸ਼ਨ ਨਹੀਂ ਮੈਂ ਇਹਨੂੰ ਲੈ ਕੇ ਜਾ ਸਕੀ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਇਹਨੂੰ ਐਜ਼ ਏ ਪ੍ਰੋਫੈਸ਼ਨ ਫੋਲੋ ਕਰਦੇ ਨੇ ਅਤੇ ਬਹੁਤ ਜ਼ਿਆਦਾ ਵਧੀਆ ਇਹਦੇ ਵਿੱਚ ਸਕੋਪ ਹੈਗਾ ਆ ਅਤੇ ਬਹੁਤ ਵਧੀਆ ਉਹ ਅਰਨਿੰਗ ਵੀ ਕਰਦੇ ਨੇ ਅਤੇ ਖੁਦ ਨੂੰ ਇੱਕ ਚ ਦੁਨੀਆਂ ਤੋਂ ਅਲੱਗ ਦਿਖਾਉਂਦੇ ਨੇ ਕਿਉਂਕਿ ਉਹ ਉਹਨਾਂ ਦੀ ਇਮੈਜ਼ੀਨੇਸ਼ਨ ਨੂੰ ਰਿਲੇ ਰਿਲੈ ਰਿਐਲਟੀ ਦੇ ਵਿੱਚ ਜ ਜਦੋਂ ਉਹ ਆਪਣੀ ਚਿੱਤਰਕਾਰੀ ਕਰਦੇ ਨੇ ਤਾਂ ਉਹ ਰ ਰਿਐਲਟੀ ਦੇ ਵਿੱਚ ਲੈ ਕੇ ਆਉਂਦੇ ਨੇ ਉਸ ਚੀਜ਼ ਨੂੰ ਤਾਂ ਚਿੱਤਰਕਾਰੀ ਬਹੁਤ ਵਧੀਆ ਚੀਜ਼ ਆ ਅਤੇ ਸਾਨੂੰ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਰੰਗ ਨੇ ਜਿਹੜੇ ਕਿ ਅਸੀਂ ਇੱਕ ਕਾਗਜ਼ ਦੇ ਉੱਤੇ ਬਖੇਰ ਕੇ ਆਪਣੀਆਂ ਭਾਵਨਾਵਾਂ ਨੂੰ ਡਿਸਕਰਾਈਬ ਕਰ ਸਕਦੇ ਹਾਂ ਆਪਣੇ ਇਮੋਸ਼ਨਸ ਨੂੰ ਚਿੱਤਰਕਾਰੀ ਦੇ ਵਿੱਚ ਪ੍ਰਜੈਂਟ ਕਰ ਸਕਦੇ ਹਾਂ